ਅਸੀਂ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਦਰ ਆਪਣੇ ਮਾਤਾ ਪਿਤਾ ਦੀ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਸਾਨੂੰ ਜੱਗ ਦਿਖਾਇਆ ਸਾਨੂੰ ਜੱਗ ਵਿਖਾ ਕੇ ਸਾਨੂੰ ਪੜਾਇਆ ਲਿਖਾਇਆ ਸਾਨੂੰ ਇੰਨੇ ਜੋਗਾ ਕੀਤਾ ਆਪਣੇ ਪੈਰਾਂ 'ਤੇ ਖੜ੍ਹੇ ਕੀਤਾ ਅਤੇ ਸਾਨੂੰ ਜ਼ਿੰਦਗੀ ਦਿੱਤੀ ਇਕ ਨਵੇਂ ਰੂਪ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਧੰਨਵਾਦੀ ਆਪਣੇ ਮਾਤਾ ਪਿਤਾ ਜੀ ਦੇ ਹਾਂ